ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਪੰਜਾਬੀ ਭਾਸ਼ਾ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਮੈਂ ਫਸਟ ਕਲਾਸ 'ਚ ਮਤਲਬ ਕਿ ਪਹਿਲੀ ਕਲਾਸ ਤੋਂ ਹੀ ਸਿੱਖੀ ਹੈ ਕਿਉਂਕਿ ਮੈਂ ਸਰਕਾਰੀ ਸਕੂਲ ਵਿੱਚ ਪੜ੍ਹੀ ਹੋਈ ਹਾਂ ਅਤੇ ਸਰਕਾਰੀ ਸਕੂਲ ਵਿੱਚ ਪਹਿਲੀ ਫਸਟ ਕਲਾਸ ਤੋਂ ਹੀ ਇਹ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਇਹ ਲੱਗ ਜਾਂਦੀ ਹੈ ਬਾਕੀ ਜਿਹੜੀ ਮੈਂ ਆਪਣੀ ਸਟੱਡੀ ਕੀਤੀ ਹੈ ਉਹਦੇ ਵਿੱਚ ਮੈਂ ਪੰਜਾਬੀ ਲਾਜ਼ਮੀ ਰੱਖੀ ਹੋਈ ਸੀਗੀ ਤਾਂ ਕਿ ਜਿਹੜੀ ਇਹ ਪੰਜਾਬੀ ਆ ਇਹ ਵਧੀਆ ਸੀਗੀ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਦੀ ਸੀ ਇਹਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਸੀਗਾ ਕਿਉਂਕਿ ਇਹਦੇ ਵਿੱਚ ਬਹੁਤ ਪਿਆਰ ਅਤੇ ਸਤਿਕਾਰ ਹੁੰਦਾ ਹੈ ਜੋ ਵੀ ਅਸੀਂ ਮਤਲਬ ਇਹਦੇ ਵਿੱਚ ਬਹੁਤ ਵਧੀਆ ਮਿਠਾਸ ਹੁੰਦੀ ਹੈ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਹਰ ਇੱਕ ਨੂੰ ਵਧੀਆ ਲੱਗਦੀ ਹੈ ਬੋਲਣ ਵਿੱਚ ਆਸਾਨੀ ਹੁੰਦੀ ਹੈ ਅਤੇ ਸਮਝਣ ਵਿੱਚ ਵੀ ਆਸਾਨੀ ਹੰਦੀ ਹੈ ਵੈਸੇ ਤਾਂ ਸਾਡੀਆਂ ਸਾਰੀਆਂ ਭਾਸ਼ਾ ਹੀ ਬਹੁਤ ਵਧੀਆ ਹਨ ਸਤਿਕਾਰ ਯੋਗ ਹਨ ਲੇਕਿਨ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਪੰਜਾਬੀਆਂ ਦੀ ਮਾਂ ਬੋਲੀ ਹੈ ਜਿਹਦੇ ਵਿੱਚ ਅਸੀਂ ਮਤਲਬ ਵਧੀਆ ਕਿਸੇ ਨਾਲ ਗੱਲ ਕਰ ਸਕਦੇ ਹਾਂ ਕਿਸੇ ਨੂੰ ਸਮਝਾ ਸਕਦੇ ਹਾਂ ਕਿਸੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ ਅਤੇ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਹਦੇ ਵਿੱਚ ਮਤਲਬ ਵਧੀਆ ਆਪਣੇ ਪਰਿਵਾਰ ਵਿੱਚ ਬਹਿ ਕੇ ਵੀ ਬੋਲ ਸਕਦੇ ਹਾਂ ਬੱਚਿਆਂ ਵਿੱਚ ਵੀ ਰਹਿ ਕੇ ਵੀ ਬੋਲ ਸਕਦੇ ਹਾਂ ਅਤੇ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਪੰਜਾਬ ਦੀ ਫੇਮਸ ਭਾਸ਼ਾ ਹੈ ਇਹ ਸਮਾਜ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਬੋਲੀ ਜਾਂਦੀ ਹੈ ਇਹ ਪੰਜਾਬੀ ਤੋਂ ਪਿਆਰ ਅਤੇ ਸਤਿਕਾਰ ਯੋਗ ਹੈ ਜਿਹਦੇ ਨਾਲ ਮੈਂ ਆਸਾਨੀ ਨਾਲ ਆਪਣੇ ਘਰਦਿਆਂ ਨੂੰ ਆਪਣੀ ਗੱਲ ਜਾਂ ਆਪਣੇ ਪੜੋਸੀਆਂ ਨੂੰ ਆਪਣੇ ਆਸ ਪਾਸ ਨੂੰ ਸਭ ਵਧੀਆ ਤਾਂ ਦੱਸ ਸਕਦੀ ਹਾਂ ਮੈਂ ਆਪਣੀ ਸਾਰੀ ਸਟੱਡੀ ਪੰਜਾਬੀ ਭਾਸ਼ਾ ਵਿੱਚ ਕੀਤੀ ਹੈ ਜਿਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਵਧੀਆ ਲੋਕ ਹੁੰਦੇ ਹਨ ਉਹ ਪੰਜਾਬੀ ਭਾਸ਼ਾ ਬੋਲਦੇ ਹਨ ਮੈਨੂੰ ਬਹੁਤ ਹੀ ਪਿਆਰੀ ਭਾਸ਼ਾ ਲੱਗਦੀ ਹੈ ਇਹਦੇ ਵਿੱਚ ਮੈਂ ਇਸ ਭਾਸ਼ਾ ਦਾ ਬਹੁਤ ਹੀ ਸਤਿਕਾਰ ਅਤੇ ਮਾਣ ਕਰਦੀ ਹਾਂ